ਮੈਂ ਰਸੋਈ ਦੀਆਂ ਕੁਛ ਕੁ ਚੀਜ਼ਾਂ ਆਨਲਾਈਨ ਮੰਗਾਈਆਂ ਸਨ ਜਿਵੇਂ ਕਿ ਗਰੈਂਡੜ ਯੂਸਰ ਪਾਣੀ ਵਾਲੇ ਗਲਾਸ ਪਾਣੀ ਵਾਲੀਆਂ ਬੋਤਲਾਂ ਜੱਗ ਇਹਨਾਂ ਦੇ ਵਿੱਚੋਂ ਹੁਣ ਮੇਰਾ ਫੈਸਲਾ ਬਦਲ ਗਿਆ ਹੈ ਇਹਨਾਂ ਵਿੱਚੋਂ ਮੈਂ ਕੁਛ ਕੁ ਚੀਜ਼ਾਂ ਵਾਪਸ ਕਰ ਰਹੀ ਹਾਂ ਯਾਨੀ ਕਿ ਪਾਣੀ ਵਾਲੇ ਜੱਗ ਪਾਣੀ ਵਾਲੀਆਂ ਬੋਤਲਾਂ ਇਹ ਮੈਨੂੰ ਪਸੰਦ ਨਹੀਂ ਆਈਆਂ ਇਹ ਆਈਟਮਾਂ ਮੈਂ ਵਾਪਸ ਕਰ ਰਹੀ ਹਾਂ ਧੰਨਵਾਦ